ਕੀ ਤੁਸੀਂ ਕਦੀ ਕਿਸੇ ਮੁਕਾਬਲੇ ਜਾਂ ਪ੍ਰਦਰਸ਼ਨੀ ਵਿੱਚ ਆਪਣੀ ਕਲਾਕਾਰੀ ਦਿਖਾਈ ਹੈ ਇਹ ਅਨੁਭਵ ਤੁਹਾਡੇ ਲਈ ਕਿਵੇਂ ਰਿਹਾ ਜੇਕਰ ਨਹੀਂ ਤਾਂ ਤੁਸੀਂ ਐਲੀਮੈਟਰੀ ਇੰਟਰਮੀਡੀਏ ਚਿੱਤਰਕਾਰੀ ਪ੍ਰੀਖਿਆਵਾਂ ਦਿੱਤੀਆਂ ਹਨ ਹਾਂਜੀ ਪ੍ਰਦਰਸ਼ਨੀ ਤਾਂ ਨਹੀਂ ਲਗਾਈ ਕਦੀ ਪਰ ਅਨੁਭਵ ਤਾਂ ਕੀਤਾ ਹੈ ਕੋਈ ਮਤਲਬ ਐਗਜੀਬਿਸ਼ਨ ਲੱਗਦੀ ਹੈ ਤਾਂ ਆਪਣਾ ਮਾਇੰਡ ਸੈੱਟ ਕਰਨ ਲਈ ਮੈਂ ਜ਼ਰੂਰ ਚਿੱਤਰਕਾਰੀ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ